ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਇੱਕ ਨੌਜਵਾਨ ਸਪੋਰਟਸ ਨਾਲ ਜੁੜਿਆ ਹੋਇਆ ਹੈ ਮੈਂ ਆਪਣੀ ਸਹੇਲੀ ਦੀ ਗੱਲ ਦੱਸਦੀ ਹਾਂ ਕਿ ਉਹ ਕਿਵੇਂ ਖੇਡਾਂ ਨਾਲ ਜੁੜੀ ਹੋਈ ਹੈ ਮੇਰੀ ਸਹੇਲੀ ਦਾ ਨਾਂ ਵੰਸ਼ਿਕਾ ਹੈ ਉਹ ਇੱਕ ਵੋਲੀਬਾਲ ਵਾਲੀ ਪਲੇਅਰ ਹੈ ਉਸਨੇ ਪੰਦਰ੍ਹਾਂ ਸਾਲ ਦੀ ਉਮਰ 'ਚ ਖੇਡਾਂ ਸ਼ੁਰੂ ਕਰਤਾ ਸੀ ਹੁਣ ਅੱਜ ਉਹ ਉੱਨੀ ਸਾਲ ਦੀ ਹੋ ਗਈ ਹੈ ਉਹ ਹੁਣ ਆਪਣਾ ਕਰੀਅਰ ਵੋਲੀਬਾਲ ਵਿੱਚ ਲੱਭ ਰਹੀ ਹੈ ਜਿਸ ਨੂੰ ਪੂਰੀ ਉਮੀਦ ਹੈ ਕਿ ਉਹ ਵੋਲੀਬੁਲ ਵਿੱਚ ਸਲੈਕਟ ਹੋ ਜਾਏਗੀ ਵਿਦਿਆਰਥੀ ਸਕੂਲ ਵਿੱਚ ਖੇਡਾਂ 'ਚ ਹਿੱਸਾ ਇਸ ਕਰਕੇ ਲੈਂਦੇ ਹਨ ਕਿ ਉਹਨਾਂ ਦਾ ਦਿਮਾਗ ਤੇਜ਼ ਚੱਲੇ ਅਤੇ ਪੜ੍ਹਾਈ 'ਚ ਦਿਮਾਗ ਵਧੀਆ ਲੱਗੇ ਉਹ ਹਰ ਇੱਕ ਕੰਮ ਬੜੀ ਫੁਰਤੀ ਨਾਲ ਕਰ ਸਕਦੇ ਹਨ ਜਿਸ ਨਾਲ ਉਹ ਤੰਦਰੁਸਤ ਵੀ ਰਹਿੰਦੇ ਹਨ ਉਹਨਾਂ ਵਿੱਚੋਂ ਹੀ ਕੋਈ ਨਾ ਕੋਈ ਅੱਗੇ ਵੱਧ ਜਾਂਦਾ ਹੈ